ਮੇਰਾ ਨਾਮ ਅਰਾਧਨਾ ਹੈ ਮੈਂ ਪਠਾਨਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਦੇਖੋ ਮੈਂ ਅਸ ਅੱਜ ਅੰਮ੍ਰਿਤਸਰ ਜਾਣਾ ਸੀ ਮੈਨੂੰ ਇੱਕ ਜ਼ਰੂਰੀ ਕੰਮ ਸੀ ਜਿਸ ਕਾਰਣ ਮੈਂ ਆਪਣੇ ਕੈਬ ਵਾਲੇ ਨੂੰ ਫੋਨ ਕੀਤਾ ਅਤੇ ਮੈਂ ਉਸ ਨੂੰ ਜਾਣ ਬਾਰੇ ਪੁੱਛਿਆ ਕਿ ਮੈਂ ਪਠਾਨਕੋਟ ਤੋਂ ਅੰਮ੍ਰਿਤਸਰ ਜਾਣਾ ਹੈ ਤੁਸੀਂ ਮੈਨੂੰ ਦੱਸੋ ਕਿ ਪਠਾਨਕੋਟ ਤੋਂ ਅੰਮ੍ਰਿਤਸਰ ਜਾਣ ਲਈ ਕਿੰਨਾ ਟ ਸਮਾਂ ਲੱਗੇਗਾ ਅਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਅਸੀਂ ਤੁਹਾਨੂੰ ਦੋ ਘੰਟਿਆਂ ਵਿੱਚ ਅੰਮ੍ਰਿਤਸਰ ਪਹੁੰਚਾ ਦੇਵਾਂਗੇ ਅਤੇ ਮੈਂ ਉਹਨਾਂ ਦੇ ਦੋ ਘੰਟੇ ਕਹਿਣ ਦੇ ਬਜਾਏ ਮੈਂ ਆਪਣੇ ਘਰੋਂ ਅੱਧਾ ਹੋਰ ਘੰਟਾ ਪਹਿਲਾਂ ਹੀ ਘਰੋਂ ਨਿਕਲ ਗਈ ਜਦੋਂ ਮੈਂ ਆਪਣੇ ਘਰੋਂ ਨਿਕਲੀ ਤਾਂ ਮੈਂ ਮੈਂ ਨਿਕਲਣਾ ਸੀ ਪਟੇਲ ਚੌਂਕ ਤੋਂ ਬੱਸ ਸਟੈਂਡ ਤੱਕ ਮੈਂ ਜਦੋਂ ਪਟੇਲ ਚੌਂਕ ਤੋਂ ਗਾਂਧੀ ਚੌਂਕ ਪਹੁੰਚੀ ਤਾਂ ਉੱਥੇ ਕੁਛ ਸੜਕ ਨਿਰਮਾਣ ਦਾ ਕੰਮ ਚੱਲ ਰਿਹਾ ਸੀ ਜਿਸ ਕਾਰਣ ਉਹ ਰਸਤਾ ਉਹਨਾਂ ਨੇ ਬੰਦ ਕੀਤਾ ਹੋਇਆ ਸੀ ਉਸ ਵਿੱਚ ਕੋਈ ਵੀ ਗੱਡੀ ਨਹੀਂ ਆ ਜਾ ਸਕਦੀ ਸੀ ਜਿਸ ਕਾਰਣ ਮੈਨੂੰ ਬਹੁਤ ਹੀ ਮੁਸ਼ਕਿਲ ਹੋਈ ਫਿਰ ਮੈਂ ਸੋਚਿਆ ਕਿਉਂ ਨਾ ਮੈਂ ਥੋੜ੍ਹਾ ਜਿਹਾ ਚੱਕਰ ਲਗਾ ਕੇ ਘੁੰਮ ਕੇ ਆਪਣਾ ਸਮਾਂ ਬ ਬਚਾਉਂਦੇ ਹੋਏ ਬਸ ਸਟੈਂਡ ਜਾਣਾ ਹੈ ਜਿਸ ਕਾਰਣ ਮੈਂ ਆਪਣਾ ਸਮਾਂ ਬਚਾਉਂਦੇ ਹੋਏ ਪ ਪਿੱਛੋਂ ਦੀ ਘੁੰਮ ਕੇ ਪੈਦਲ ਹੀ ਇੱਕ ਸਾਈਡ ਤੋਂ ਨਿਕਲ ਕੇ ਆ ਗਈ ਫਿਰ ਮੈਂ ਆ ਕੇ ਆਪਣੇ ਡਰਾਈਵਰ ਨੂੰ ਫੋਨ ਕੀਤਾ ਕਿ ਮੈਂ ਤੁਹਾਨੂੰ ਜਿੱਥੋਂ ਚੁੱਕਣ ਨੂੰ ਕਿਹਾ ਸੀ ਉਹ ਰਸਤਾ ਸੜਕ ਨਿਰਮਾਣ ਕਾਰਣ ਬੰਦ ਹੈ ਉੱਧਰ ਕੋਈ ਵੀ ਸਾਧਨ ਨਹੀਂ ਜਾ ਰਿਹਾ ਹੁਣ ਤੁਸੀਂ ਮੈਨੂੰ ਅਲੱਗ ਜਗ੍ਹਾ ਤੋਂ ਚੁੱਕਣਾ ਹੈ ਜਿਸ ਲਈ ਮੈਂ ਤੁਹਾਨੂੰ ਪੁੱਛ ਰਹੀ ਹਾਂ ਕਿ ਤੁਸੀਂ ਮੈਨੂੰ ਕ ਉੱਥੋਂ ਕਿੰਨੇ ਵਜੇ ਚੁੱਕੋਗੇ ਤੁਸੀਂ ਮੈਨੂੰ ਇਹ ਹੁਣ ਦੱਸੋ